ਟੈਕਨੋਲਜੀ ਨੇ ਟਰਾਂਸਪੋਰਟੇਸ਼ਨ ਨੂੰ ਆਸਾਨ ਬਣਾਉਣ ਵਿੱਚ ਬਹੁਤ ਮਦਦ ਕੀਤੀ ਹੈ ਜਿਵੇਂ ਕੀ ਟਿਕਟ ਬੁਕਿੰਗ ਦੇ ਮਾਮਲੇ ਵਿੱਚ ਭਾਵੇਂ ਰੇਲਵੇ ਦੀ ਟਿਕਟ ਹੋਵੇ ਜਾਂ ਬੱਸ ਟਿਕਟ ਜਾਂ ਐਰੋਪਲੇਨ ਦੀ ਟਿਕਟ ਵੀ ਹੋਵੇ ਤਾਂ ਉਹ ਟਿਕਟ ਆਪਾਂ ਓਨਲਾਈਨ ਬੁੱਕ ਆਪਣੇ ਫੋਨ ਤੋਂ ਘਰ ਬੈਠੇ ਵਿੱਚ ਹੀ ਕਰ ਸਕਦੇ ਹਾਂ ਭਾਵੇਂ ਆਪਾਂ ਇੱਕ ਜਣੇ ਦੀ ਕਰਨੀ ਹੋਵੇ ਭਾਵੇਂ ਦਸ ਦੀ ਕਰਨੀ ਹੋਵੇ ਸਾਰਿਆਂ ਦੀ ਘਰ ਬੈਠੇ ਹੀ ਟਿਕਟ ਬੁੱਕ ਹੋ ਜਾਂਦੀ ਹੈ ਇਸ ਦੇ ਨਾਲ ਸਮੇਂ ਦਾ ਬਹੁਤ ਬਚਾਅ ਹੁੰਦਾ ਹੈ ਪੁਰਾਣੇ ਜ਼ਮਾਨੇ ਵਿੱਚ ਆਪਾਂ ਨੂੰ ਓਫਿਸ ਵਿੱਚ ਜਾ ਕੇ ਟਿਕਟ ਬੁੱਕ ਕਰਵਾਉਣੀ ਪੈਂਦੀ ਸੀ ਜਿਹਦੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਸੀ ਅਤੇ ਖਰਚਾ ਵੀ ਆਉਣ ਜਾਣ ਦਾ ਲੱਗ ਜਾਂਦਾ ਸੀ ਹੁਨ ਇਹ ਜਿਹੀ ਕੋਈ ਚੀਜ਼ ਨਹੀਂ ਹੁੰਦੀ ਨਾਲੇ ਜੇ ਕੋਈ ਰੇਲਵੇ ਜਾਂ ਹਵਾਈ ਜਹਾਜ਼ ਦੀ ਟਿਕਟ ਨਹੀਂ ਹੈ ਉਸ ਦਾ ਆਪਾਂ ਨੂੰ ਉਸ ਹੀ ਸਮੇਂ ਪਤਾ ਚੱਲ ਜਾਂਦਾ ਹੈ ਜਿਸ ਦੇ ਨਾਲ ਆਪਾਂ ਆਪਣਾ ਕੋਈ ਹੋਰ ਪਲੈਨ ਵੀ ਕਰ ਸਕਦੇ ਹਾਂ ਨਾਲੇ ਟੈਕਨੋਲਜੀ ਨੇ ਹੋਟਲ ਬੁਕਿੰਗ ਦੇ ਵਿੱਚ ਵੀ ਬਹੁਤ ਮਦਦ ਕੀਤੀ ਹੈ ਭਾਵੇਂ ਅਪਡੇਟ ਯਾਤਰਾ ਦਾ ਵਾਰ ਕਰਨਾ ਹੋਵੇ ਪਲੈਟਫੋਰਮ ਨੰਬਰ 'ਤੇ ਸਟੇਸ਼ਨ ਜਾਂ ਬੱਸ ਡਿਪੋਰਟ ਸਥਾਨ ਵੀ ਪਤਾ ਚੱਲ ਜਾਂਦੇ ਹਨ ਹੋਟਲ ਬੁਕਿੰਗ ਵੀ ਆਪਾਂ ਟੈਕਨੋਲਜੀ ਦੇ ਨਾਲ ਕਰ ਸਕਦੇ ਹਾਂ ਆਪਾਂ ਨੂੰ ਬਹੁਤ ਸਾਰੇ ਹੋਟਲ ਦੀ ਓਪਸ਼ਨਾਂ ਮਿਲ ਜਾਂਦੀਆਂ ਹਨ ਜੇਕਰ ਆਪਾਂ ਪੁਰਾਣੇ ਜ਼ਮਾਨੇ ਵਿੱਚ ਜਾਈਏ ਉਦੋਂ ਆਪਾਂ ਨੂੰ ਆਪਣੀ ਸਥਾਨ 'ਤੇ ਪਹੁੰਚਣ ਤੋਂ ਬਾਅਦ ਅਲੱਗ ਤੋਂ ਲੱਭਣਾ ਪੈਂਦਾ ਸੀ ਜਿਸ ਦੇ ਕਰਕੇ ਬਹੁਤ ਹਾਨੀਆਂ ਹੁੰਦੀਆਂ ਸਨ ਹੁਣ ਆਪਾਂ ਪੂਰੀ ਆਪਣੀ ਇੱਕ ਜਰਨੀ ਪਲੈਨ ਕਰ ਸਕਦੇ ਹਾਂ ਜਿਹਦੇ ਵਿੱਚ ਆਪਾਂ ਹੋਟਲ ਵੀ ਪਹਿਲਾਂ ਤੋਂ ਬੁੱਕ ਕਰ ਸਕਦੇ ਹਾਂ ਟਿਕਟ ਨੂੰ ਬੁੱਕ ਕਰਨ ਤੋਂ ਬਾਅਦ ਜੇ ਆਪਾਂ ਹੋਟਲ 'ਤੇ ਆਈਏ ਤਾਂ ਆਪਾਂ ਨੂੰ ਘੱਟੋਂ ਘੱਟ ਦਸ ਬਾਰਾਂ ਹੋਟਲ ਤਾਂ ਆਮ ਹੀ ਮਿਲ ਜਾਂਦੇ ਹਨ ਉਹਨਾਂ ਵਿੱਚ ਆਪਾਂ ਰੇਟ ਦੇ ਹਿਸਾਬ ਨਾਲ ਜਿਸ ਵੀ ਆਪਣੇ ਬਜਟ ਦੇ ਹਿਸਾਬ ਨਾਲ ਹੋਟਲ ਬੁੱਕ ਕਰ ਸਕਦੇ ਹਾਂ ਨਾਲੇ ਇਸ ਦੇ ਨਾਲ ਆਪਣਾ ਸਮੇਂ ਦੀ ਬਚਾਅ ਤਾਂ ਹੁੰਦੀ ਹੀ ਹੈ ਅਤੇ ਖੱਜਲ ਵੀ ਘੱਟ ਹੁੰਦੀ ਹੈ ਅਪਡੇਟ ਯਾਤਰਾ ਵਾਰ ਦਾ ਵੀ ਪਤਾ ਚੱਲ ਜਾਂਦਾ ਹੈ ਨਾਲੇ ਜਿਸ ਰੇਲਵੇ ਤੋਂ ਆਪਾਂ ਚੱਲੇ ਹਾਂ ਜਿਸ ਟਰੇਨ ਤੋਂ ਆਪਾਂ ਚੱਲੇ ਹਾਂ ਉਸਦਾ ਪਲੈਟਫੋਰਮ ਨੰਬਰ ਵੀ ਆਪਾਂ ਨੂੰ ਪਹਿਲਾਂ ਪਤਾ ਹੋ ਚੱਲ ਜਾਂਦਾ ਹੈ ਜਿਸ ਦੇ ਨਾਲ ਰੇਲਵੇ ਸਟੇਸ਼ਨ 'ਤੇ ਉਲਝਣਾਂ ਘੱਟ ਹੁੰਦੀਆਂ ਹਨ ਅੱਜ ਕੱਲ੍ਹ ਰੇਲਵੇ ਸਟੇਸ਼ਨ 'ਤੇ ਬਹੁਤ ਰੱਸ਼ ਹੁੰਦਾ ਹੈ ਜੇ ਆਪਾਂ ਨੂੰ ਪਲੈਟਫੋਰਮ ਨੰਬਰ ਪਹਿਲਾਂ ਹੀ ਪਤਾ ਹੋਵੇ ਤਾਂ ਆਪਣੀ ਜਰਨੀ ਸ਼ਾਂਤੀ ਨਾਲ ਸਮਾਪਤ ਹੁੰਦੀ ਹੈ ਨਾਲੇ ਸ਼ੁਰੂ ਵੀ ਸ਼ਾਂਤੀ ਨਾਲ ਹੁੰਦੀ ਹੈ ਜੇਕਰ ਪਲੈਟਫੋਰਮ ਨੰਬਰ ਹੀ ਨਾ ਪਤਾ ਹੋਵੇ ਅਤੇ ਆਪਾਂ ਲੱਭਦੇ ਹੀ ਰਹੀਏ ਤਾਂ ਆਪਾਂ ਉਲਝ ਸਕਦੇ ਹਾਂ ਬੱਸ ਡਿਪੋਰਟ ਸਥਾਨ ਦਾ ਵੀ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਆਪਣੀ ਬੱਸ ਨੇ ਆਪਾਂ ਨੂੰ ਕਿੱਥੇ ਉਤਾਰਨਾ ਹੈ ਅੱਜ ਕੱਲ੍ਹ ਕਈ ਬੱਸ ਟਿਕਟ ਬੁਕਿੰਗ ਵੈਬਸਾਈਟ ਹੁੰਦੀਆਂ ਹਨ ਜਿਵੇਂ ਕਿ ਰੈਡਬੱਸ ਬੁਕਿੰਗ ਹੋ ਗਈ ਅਤੇ ਬਾਕੀ ਆਦਿ ਵੈੱਬਸਾਈਟ ਉਹ ਤਾਂ ਬੰਦੇ ਨੂੰ ਫੋਨ ਵੀ ਕਰ ਦਿੰਦੀਆਂ ਹਨ ਕਿ ਜੀ ਤੁਹਾਡਾ ਸਫ਼ਰ ਕਿੱਦਾਂ ਦਾ ਰਿਹਾ ਤੁਸੀਂ ਪਹੁੰਚੇ ਕੇ ਨਹੀਂ ਪਹੁੰਚੇ ਇਹ ਸਭ ਸੁਵਿਧਾਵਾਂ ਓਨਲਾਈਨ ਟਿਕਟ ਬੁਕਿੰਗ 'ਤੇ ਹੀ ਮਿਲਦੀਆਂ ਹਨ ਅਤੇ ਇਹ ਸਾਰੀ ਟੈਕਨੋਲਜੀ ਦੀ ਦੇਣ ਹੀ ਹੈ ਟੈਕਨੋਲਜੀ ਨੇ ਟਰਾਂਸਪੋਰਟੇਸ਼ਨ ਨੂੰ ਬਹੁਤ ਆਸਾਨ ਬਣਾਇਆ ਹੈ ਟੈਕਨੋਲਜੀ ਇੱਕ ਇਹ ਜਿਹੀ ਚੀਜ਼ ਹੈ ਜਿਹੜੀ ਕਿ ਅੱਗੇ ਜਾ ਕੇ ਸਿਰਫ਼ ਟਰਾਂਸਪੋਰਟੇਸ਼ਨ ਹੀ ਨਹੀਂ ਹੋਰ ਵੀ ਥਾਵਾਂ ਨੂੰ ਬਹੁਤ ਕੰਮ ਆਊਗੀ ਟਰਾਂਸਪੋਰਟੇਸ਼ਨ ਸੈਕਟਰ ਟੈਕਨੋਲਜੀ ਦਾ ਬਹੁਤ ਹੀ ਜ਼ਿਆਦਾ ਮਦਦਗਾਰ ਹੋਇਆ